ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਸਾਰੇ ਪੰਜਾਬ ਵਿੱਚ ਰਹਿੰਦੇ ਹਾਂ ਅਤੇ ਪੰਜਾਬ ਹੈ ਜਿਹੜਾ ਉਹ ਸਿੱਖਾਂ ਦੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਸਿੱਖ ਧਰਮ ਨਾਲ ਸੰਬੰਧਿਤ ਨੇ ਅਤੇ ਸਿੱਖਾਂ ਦੇ ਅਗਰ ਧਾਰਮਿਕ ਸਥਾਨਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਦੁਆਰਾ ਸਾਹਿਬ ਨੇ ਜਿਹੜੇ ਉਹ ਬਹੁਤ ਹੀ ਜ਼ਿਆਦਾ ਸਤਿਕਾਰਤ ਅਤੇ ਪੂਜਣ ਯੋਗ ਸਥਾਨ ਨੇ ਸਾਰਾ ਹੀ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਮੁਸਲਿਮ ਭਾਈਚਾਰਾ ਸਾਰੇ ਦੇ ਸਾਰੇ ਜੇ ਹੋ ਜੋ ਹੋਰ ਵੀ ਜਿਹੜੇ ਧਰਮਾਂ ਦੇ ਲੋਕ ਪੰਜਾਬ 'ਚ ਰਹਿੰਦੇ ਆ ਸਾਰੇ ਦੇ ਸਾਰੇ ਗੁਰੂ ਘਰਾਂ ਦੀ ਬਹੁਤ ਜ਼ਿਆਦਾ ਸਤਿਕਾਰ ਇੱਜ਼ਤ ਭਾਵਨਾ ਕਰਦੇ ਹੈਗੇ ਅਤੇ ਉੱਥੇ ਇਕੱਠੇ ਹੋ ਕੇ ਜਾਂਦੇ ਹੈ ਜੇਕਰ ਮੈਂ ਨਿੱਜੀ ਤੌਰ 'ਤੇ ਗੱਲ ਕਰਾਂ ਤਾਂ ਮੈਂ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਜਿਹੜਾ ਜਾਣਾ ਉਹ ਸਭ ਤੋਂ ਜ਼ਿਆਦਾ ਪਸੰਦ ਕਰਦੀ ਹਾਂ ਇਹਦੇ ਪਿੱਛੇ ਕਾਰਨ ਇਹ ਹੈ ਕਿ ਇਹ ਸਿੱਖਾਂ ਦਾ ਸਭ ਤੋਂ ਪਹਿਲਾ ਜਿਹੜਾ ਧਾਰਮਿਕ ਸਥਾਨ ਹੈਗਾ ਜਿਹਦੀ ਸਥਾਪਨਾ ਕਿ ਉਹ ਗੁਰੂ ਰਾਮਦਾਸ ਜੀ ਨੇ ਕੀਤੀ ਸੀਗੀ ਅਤੇ ਇੱਥੋਂ ਦੀ ਜਿਹੜੀ ਨੀਂਹ ਹੈ ਉਹ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ ਜਿੱਥੋਂ ਸਾਨੂੰ ਇਹ ਚੀਜ਼ ਪਤਾ ਲੱਗਦੀ ਹੈ ਕਿ ਇਹ ਗੁਰਦੁਆਰਾ ਜਿਹੜਾ ਉਹ ਸਿਰਫ ਸਿੱਖਾਂ ਦਾ ਨਾ ਹੋ ਕੇ ਸਾਰੇ ਧਰਮਾਂ ਦਾ ਸਾਂਝਾ ਗੁਰੂ ਘਰ ਹੈ ਅਤੇ ਜਿਹੜੇ ਗੁਰੂ ਘਰ ਨੇ ਉਹ ਸਾਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਨੇਗੇ ਇਹੀ ਸਭ ਤੋਂ ਵੱਡੀ ਜਿਹੜੀ ਗੁਰੂ ਸਿੱਖਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਮਹੱਤਤਾ ਹੈ ਇਸ ਤੋਂ ਇਲਾਵਾ ਜਿਹੜਾ ਲੰਗਰ ਅਤੇ ਪੰਗਤ ਦਾ ਸੰਕ ਕਨਸੈਪਟ ਹੈਗਾ ਉਹ ਸਾਨੂੰ ਇਹ ਚੀਜ਼ ਸਿਖਾਉਂਦਾ ਕਿ ਸਾਰੇ ਇਕੁਅਲ ਨੇ ਕੋਈ ਵੀ ਊਚ ਨੀਚ ਜਾਂ ਉੱਚਾ ਨੀਵਾਂ ਅਮੀਰ ਗਰੀਬ ਹੈ ਜਿਹੜਾ ਉਹ ਨਹੀਂ ਹੈਗਾ ਗਾ ਧੰਨਵਾਦ